ਇਤਿਹਾਸ ਦੌਰਾਨ ਸਮੇਂ ਵਿੱਚ ਸਾਡੇ ਖੇਤਰ 'ਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਸਨ ਜਿਵੇਂ ਕਿ ਮੁਸਲਮਾਨ ਇਸਾਈ ਸਿੱਖ ਧਰਮ ਹਿੰਦੂ ਅਤੇ ਆਪਸ 'ਚ ਬਹੁਤ ਹੀ ਪਿਆਰ ਅਤੇ ਏਕਤਾ ਰੱਖਦੇ ਸਨ ਅਤੇ ਵਿਸ਼ਵਾਸ ਰੱਖਦੇ ਸਨ ਅਤੇ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕਰਦੇ ਸਨ ਜਿਵੇਂ ਕਿ ਕਿਸੇ ਲੋੜਵੰਦ ਪਰਿਵਾਰ ਦੀ ਹਰੇਕ ਮਦਦ ਕਰਦੇ ਸਨ ਆਪਸ 'ਚ ਬਹੁਤ ਹੀ ਪਿਆਰ ਨਾਲ ਰਹਿੰਦੇ ਸਨ ਜਿਵੇਂ ਕਿ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਹੁੰਦਾ ਸੀ ਅਤੇ ਸਾਰੇ ਲੋਕ ਉਸ ਨੂੰ ਆਪਣੀ ਧੀ ਭੈਣ ਸਮਝਦੇ ਸਨ ਅਤੇ ਉਸਦਾ ਰਲ ਕੇ ਵਿਆਹ ਕਰਦੇ ਸਨ ਜਿਵੇਂ ਕਿ ਹਰੇਕ ਘਰ ਵਿੱਚ ਕੋਈ ਨਾ ਕੋਈ ਆ ਕੋਈ ਖੰਡ ਦੀ ਬੋਰੀ ਚੀਨੀ ਦਾ ਮਤਲਬ ਤੇਲ ਦਾ ਪੀਪਾ ਹਰੇਕ ਸਮਾਨ ਕੋਈ ਸਬਜ਼ੀਆਂ ਦੇ ਜਾਂਦਾ ਸੀ ਕੋਈ ਦਾਜ ਵਗੈਰਾ ਦੇ ਜਾਂਦਾ ਸੀ ਜਿਵੇਂ ਕਿਸੇ ਨੇ ਅਲਮਾਰੀ ਦੇ ਤੀ ਕੂਲਰ ਫਰਿੱਜ਼ ਫਰਨੀਚਰ ਦਾ ਸਮਾਨ ਦੇ ਤਾ ਅਤੇ ਕੁੜੀਆਂ ਦਾ ਵਿਆਹ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੇ ਸੀ ਅਤੇ ਆਪਸ 'ਚ ਬਹੁਤ ਹੀ ਰਲ ਕੇ ਰਹਿੰਦੇ ਸਨ ਅਤੇ ਕੁੜੀਆਂ ਦਾ ਵਿਆਹ ਬਹੁਤ ਵਧੀਆ ਹੋ ਜਾਂਦਾ ਸੀ ਅਤੇ ਇਸ ਕਰਕੇ ਸਿੱਖ ਧਰਮ ਦੇ ਲੋਕ ਬਹੁਤ ਹੀ ਪਿਆਰ ਦਿੰਦੇ ਸਨ ਅਤੇ ਸਾਰੇ ਆਪਸ 'ਚ ਰਲ ਕੇ ਰਹਿੰਦੇ ਸਨ ਬਹੁਤ ਹੀ ਸਾਰੇ ਆਪਸ 'ਚ ਪਿਆਰ ਅਤੇ ਏਕਤਾ ਵਿਸ਼ਵਾਸ ਬਣਾਈ ਰੱਖਦੇ ਸਨ ਅਤੇ ਅਤੇ ਇੱਕ ਦੂਜੇ ਨਾਲ ਦੁੱਖ ਸੁੱਖ ਆਪਣੇ ਸਾਂਝੇ ਕਰਦੇ ਸਨ ਹਰੇਕ ਦੁੱਖ ਸੁੱਖ ਵਿੱਚ ਖੜ੍ਹਦੇ ਸਨ ਹਰੇਕ ਆਉਣ ਜਾਣ ਨਾਲ ਆਪਸ 'ਚ ਪਿਆਰ ਅਤੇ ਏਕਤਾ ਬਹੁਤ ਸੀ ਉੱਦੋਂ